ਗਿਆਰ੍ਹਾਂ ਨਵੰਬਰ ਉੱਨੀ ਛਿਆਨਵੇਂ ਦਸ ਮਾਰਚ ਦੋ ਹਜ਼ਾਰ ਦਸ ਪੱਚੀ ਅਗਸਤ ਉੱਨੀ ਸੌ ਸਤਾਨਵੇਂ ਅਠਾਈ ਜਨਵਰੀ ਦੋ ਹਜ਼ਾਰ ਅੱਠ ਦਸ ਅਗਸਤ ਉੱਨੀ ਸੌ ਛਿਆਨਵੇਂ